ਮੈਂ ਬਗੀਚੇ ਵਿੱਚ ਪੌਦੇ ਲਾਉਣ ਲਈ ਉਹਨਾਂ ਨੂੰ ਨਾਲ ਦੇ ਸ਼ਹਿਰ ਦੀ ਨਰਸਰੀ ਤੋਂ ਪ੍ਰਾਪਤ ਕਰਦਾ ਹਾਂ ਅਤੇ ਕੁਝ ਪੌਦੇ ਜਿਹੜੇ ਹੈਗੇ ਆ ਉਹਨਾਂ ਦੀ ਪਲਾਟੇਸ਼ਨ ਮੈਂ ਖੁਦ ਕਰਦਾ ਹਾਂ ਜਿਵੇਂ ਕਿ ਕੁਛ ਫੁੱਲਦਾਰ ਪੌਦੇ ਹਨ ਉਹਨਾਂ ਦੇ ਬੀਜ ਨੂੰ ਸੁਕਾ ਕੇ ਅਤੇ ਅੱਛੀ ਤਰ੍ਹਾਂ ਖਾਦ ਪਾ ਕੇ ਪਾਣੀ ਪਾ ਕੇ ਅਤੇ ਮੈਂ ਉਹਨਾਂ ਨੂੰ ਪੈਦਾ ਕਰਦਾ ਹਾਂ ਅਤੇ ਪੈਦਾ ਕਰਕੇ ਜਦੋਂ ਉਹ ਪੌਦਾ ਤਕਰੀਬਨ ਥੋੜ੍ਹਾ ਵੱਡਾ ਹੋ ਜਾਂਦਾ ਹੈ ਤਾਂ ਉਸ ਨੂੰ ਮੈਂ ਅੱਗੇ ਬਗੀਚੇ ਦੇ ਵਿੱਚ ਜਿਸ ਤਰ੍ਹਾਂ ਮੈਂ ਪਲਾਟੇਸ਼ਨ ਕੀਤੀ ਹੋਈ ਆ ਉਸ ਤਰ੍ਹਾਂ ਉਸਨੂੰ ਲਗਾ ਦਿੰਦਾ ਹਾਂ ਉਸ ਟਾਈਪ ਦੇ ਕਿਆਰੀਆਂ ਬਣਾ ਕੇ ਕਿਆਰੀਆਂ ਦੇ ਵਿੱਚ ਉਹਨਾਂ ਪੌਦਿਆਂ ਨੂੰ ਲਗਾਉਂਦਾ ਹਾਂ ਤਾਂ ਜੋ ਮੇਰਾ ਬਗੀਚਾ ਸੁੰਦਰ ਅਤੇ ਵਧੀਆ ਲੱਗੇ ਅਤੇ ਜੋ ਬੂਟੇ ਸੁੱਕ ਜਾਂਦੇ ਹਨ ਉਹਨਾਂ ਨੂੰ ਮੈਂ ਪੁੱਟ ਕੇ ਬਾਹਰ ਕੱਢ ਦਿੰਦਾ ਹਾਂ ਅਤੇ ਉਹਨਾਂ ਦਾ ਜੋ ਬੀਜ ਹੁੰਦਾ ਉਸ ਨੂੰ ਸੁਕਾ ਕੇ ਆਪਣੇ ਕੋਲ ਰੱਖ ਲੈਂਦਾ ਹਾਂ ਇਸ ਤਰ੍ਹਾਂ ਹੀ ਮੈਂ ਅੱਗੇ ਦੀ ਅੱਗੇ ਕੁਛ ਬੂਟੇ ਨਾਲ ਲੈਂਦਾ ਹਾਂ ਅਤੇ ਕੁਛ ਬੂਟੇ ਮੈਂ ਆਪਣੇ ਕੋਲ ਹੀ ਚੰਗੀ ਤਰ੍ਹਾਂ ਖਾਦ ਪਾ ਕੇ ਪਾਣੀ ਪਾ ਕੇ ਅਤੇ ਬੀਜ ਨੂੰ ਲਾ ਕੇ ਅਤੇ ਪੈਦਾ ਕਰ ਲੈਂਦਾ ਹਾਂ